ਉੱਦਾਂ ਤਾਂ ਸਾਰਾ ਭਾਰਤ ਹੀ ਬਹੁਤ ਹੀ ਵਧੀਆ ਘੁੰਮਣ ਵਾਲਾ ਦੇਸ਼ ਹੈ ਜੇ ਇਹਦੇ ਵਿੱਚੋਂ ਇੱਕ ਰਾਜ ਦੀ ਗੱਲ ਕੀਤੀ ਜਾਵੇ ਕਿ ਕਿਹੜਾ ਰਾਜ ਸਾਨੂੰ ਪਸੰਦ ਹੈ ਕਿਹੜੀ ਸਟੇਟ ਸਾਨੂੰ ਪਸੰਦ ਹੈ ਤਾਂ ਮੈਂ ਪੰਜਾਬ ਦਾ ਨਾਮ ਲਵਾਂਗਾ ਮੈਂ ਪੰਜਾਬ ਦਾ ਹੀ ਰਹਿਣ ਵਾਲਾ ਹਾਂ ਪੰਜਾਬ ਦੇ ਸਾਰੀਆਂ ਜਗ੍ਹਾ ਨੂੰ ਮੈਂ ਜਾਣਦਾ ਹੈ ਚੰਗੀ ਤਰ੍ਹਾਂ ਇੱਥੇ ਗੋਡਲਨ ਟੈਪਲ ਨਾਮ ਦੀ ਇੱਕ ਬਹੁਤ ਵਧੀਆ ਟੂਰਿਸਟ ਜਗ੍ਹਾ ਹੈ ਜਿੱਥੇ ਸਾਰੀ ਹੀ ਦੁਨੀਆ ਦੇ ਲੋਕ ਆਉਂਦੇ ਨੇ ਐਜ਼ ਏ ਟੂਰਿਸਟ ਐਜ਼ ਏ ਰਿਲੀਜ਼ਨ ਜਗ੍ਹਾ ਧਾਰਮਿਕ ਜਗ੍ਹਾ ਦੇ ਕਾਰਨ ਉੱਥੇ ਮੱਥਾ ਟੇਕਣ ਆਉਂਦੇ ਨੇ ਅਸੀਂ ਵੀ ਕਈ ਵਾਰ ਗਏ ਹਾਂ ਉੱਥੇ ਬਹੁਤ ਵਧੀਆ ਜਗ੍ਹਾ ਹੈ ਅਤੇ ਬਾਕੀ ਰਹੀ ਕਿ ਮੈਂ ਕਿੱਥੇ ਘੁੰਮਣਾ ਚਾਹੁੰਗਾ ਪੰਜਾਬ ਤਾਂ ਮੈਂ ਸਾਰਾ ਘੁੰਮ ਲਿਆ ਵਾਂ ਮੇਰੀ ਇੱਛਾ ਹੈ ਕਿ ਆਉਣ ਵਾਲੀ ਛੁੱਟੀਆਂ ਵਿੱਚ ਮੈਂ ਆਪਣੇ ਪੂਰੇ ਪਰਿਵਾਰ ਦੇ ਨਾਲ ਸ਼ਿਮਲੇ ਜਾਵਾਂ ਜਿੱਥੇ ਕਈ ਮੈਂ ਫੋਟੋਜ਼ ਦੇਖੀਆਂ ਆਪਣੇ ਫ੍ਰੈਂਡਜ਼ ਦੀਆਂ ਵੀ ਬਹੁਤ ਅੱਛੀਆਂ ਬਰਫ਼ ਵਾਲੀ ਬਰਫ਼ਾਂ ਵਾਲੀਆਂ ਜਗ੍ਹਾ ਨੇ ਜਿੱਥੇ ਅਸੀਂ ਘੁੰਮ ਸਕਦੇ ਹੈ ਕਈ ਟੂਰਿਸਟ ਪਲੇਸ ਨੇ ਉੱਥੇ ਅਤੇ ਮੇਰੀ ਇਹੀ ਇੱਛਾ ਹੈ ਕਿ ਮੈਂ ਵੀ ਉੱਥੇ ਜਾ ਕੇ ਆਵਾਂ ਆਪਣੇ ਪਰਿਵਾਰ ਨਾਲ ਆਪਣੀਆਂ ਆਉਣ ਵਾਲੀਆਂ ਸਰਦੀ ਦੀਆਂ ਛੁੱਟੀਆਂ ਉੱਥੇ ਬਿਤਾਵਾ ਬਰਫ਼ ਵਿੱਚ ਅਸੀਂ ਵੀ ਜਾਈਏ ਉੱਥੇ ਬਹੁਤ ਵਧੀਆ ਮੋਲਸ ਨੇ ਉੱਥੇ ਖਾਣ ਦੀਆਂ ਕਈ ਰੈਸਟੋਰੈਂਟਸ ਨੇ ਜਿੱਥੇ ਅਸੀਂ ਘੁੰਮਣਾ ਚਾਹੁੰਦੇ ਹਾਂ ਅਤੇ ਆਈ ਹੌਪ ਕਿ ਮੈਂ ਉੱਥੇ ਜਾਊਂਗਾ ਆਉਣ ਵਾਲੀ ਛੁੱਟੀਆਂ ਵਿੱਚ